ਵਿਆਹ ਵਰਗੇ ਵੱਡੇ ਸਮਾਰੋਹ ਦੌਰਾਨ ਵੱਡੀ ਮਾਤਰਾ ਵਿੱਚ ਪਾਣੀ ਦਾ ਪ੍ਰਬੰਧ ਕਰਨ ਲਈ ਅਸੀਂ ਟੈਂਕਰ ਮੰਗਵਾਉਂਦੇ ਹਾਂ ਅਤੇ ਪਾਣੀ ਪੀਣ ਦੇ ਲਈ ਡਿਸਪੋਜ਼ਲ ਦੀ ਵਰਤੋਂ ਕੀਤੀ ਜਾਂਦੀ ਹੈ